ਬਿਮਾਰੀਆਂ ਨੂੰ ਪਛਾਣਨਾ ਅਤੇ ਇਹਨਾਂ ਦੀ ਪ੍ਰਤੀਕਿਰਿਆ ਕਰਨਾ ਇੱਕ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਇਸ ਨਾਲ ਸਿਹਤ ਪ੍ਰਾਣ ਲਈ ਅਨੁਕੂਲ ਪਰਿਵਰਤਨ ਲਈ ਅਧਿਆਤਮਕ ਅਧਿਆਪਨ ਮਿਲਦਾ ਹੈ ਬਿਮਾ ਪੰ ਬਿਮਾਰੀਆਂ ਤੋਂ ਬਚਣ ਲਈ ਅਤੇ ਸਿਹਤਮੰਦ ਰਹਿਣ ਲਈ ਸਾਡੇ ਕੁਝ ਮੁੱਖ ਚੀਜ਼ ਹਨ ਨਿਮਿਤ ਵਿਸ਼ੇਸ਼ ਦੇਖਭਾਲ ਨਿਮਿਤ ਚੈੱਕਅਪ ਕਰਵਾਉਣਾ ਅਤੇ ਕਿਸੇ ਵੀ ਬਿਮਾਰੀ ਦੀ ਸੰਭਾਵਨਾ ਤੋਂ ਬਚਾਓ ਲਈ ਡਾਕਟਰ ਦੇ ਸਲਾਹ ਅਨੁਸਾਰ ਇਲਾਜ ਲਈ ਜਾਂਚ ਕਰਵਾਉਣਾ ਜ਼ਰੂਰੀ ਹੈ ਸਮਰੱਥ ਭੋਜਨ ਸਮਰੱਥ ਖਾਣ ਪੀਣ ਤੋਂ ਸਿਹਤ ਸੁਧਾਰ ਹੋਵੇਗਾ ਇਸ ਲਈ ਫਲ ਸਬਜ਼ੀਆਂ ਅਤੇ ਬੀਬਰ ਯੁਕਤ ਅਨਾਜ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਨਿਮਿਤ ਵਿਭਾਗੀ ਨਿਯਮਿਤ ਰੂਟੀਨ ਵਿੱਚ ਵਿਆਮ ਕਰਨਾ ਬਿਮਾਰੀਆਂ ਨਾਲ ਜਾਤ ਵਿੱਚ ਮਦਦਗਾਰ ਹੈ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਕਰਦਾ ਹੈ ਧੂਮਮ ਪਾਨ ਅਤੇ ਨਸ਼ੇ ਤੋਂ ਬਚਾਓ ਧੂਮਰ ਪਾਨ ਅਤੇ ਨਸ਼ੇ ਨੂੰ ਸਮਿਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹ ਗੱਲਾਂ ਮੈਨੂੰ ਸਿਹਤਮੰਦ ਰਹਿਣ ਵਿੱਚ ਮਦਦਗਾਰ ਹੁੰਦੀਆਂ ਹਨ ਅਤੇ ਇਹਨਾਂ ਨੂੰ ਅਮਲ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਕਿ ਸਿਹਤ ਅਤੇ ਚੰਗੀ ਤਰੀਕੇ ਨਾਲ ਜੀਵਨ ਜੀਵਨ ਸਕੇ